ਅਸੀਂ ਆਰਮੀ ਵਿੱਚ ਜੋਬ ਕਰਦੇ ਸੀ ਹੁਣ ਸਾ ਕਾਨਪੁਰ ਅਸੀਂ ਰਹਿੰਦੇ ਸੀ ਅਤੇ ਹੁਣ ਸਾਡੀ ਟਰਾਂਸਫਰ ਇੱਥੇ ਪੰਜਾਬ ਵਿੱਚ ਹੋ ਗਈ ਹੈ ਔਰ ਸਾਨੂੰ ਗੈਸ ਦੀ ਗੈਸ ਸਿਲੰਡਰ ਦਾ ਪਤਾ ਅਪਡੇਟ ਕਰਨਾ ਪਵੇਗਾ ਹੁਣ ਅਸੀਂ ਪੁੱਛਦੇ ਹਾਂ ਗੈਸ ਏਜੰਸੀ ਵਿੱਚ ਜਾ ਕੇ ਪਤਾ ਕਰਦੇ ਹਾਂ ਕਿ ਸਾਡੀ ਗੈਸ ਦੀ ਪ੍ਰਕਿ ਗੈਸ ਦੀ ਦੇ ਪਤੇ ਨੂੰ ਅਪਡੇਟ ਕਰ ਦਿਉ ਕੋਸ਼ਿਸ਼ ਤਾਂ ਸਾਡੀ ਇਹ ਹੀ ਹੋਵੇਗੀ ਕਿ ਜਲਦੀ ਤੋਂ ਜਲਦੀ ਸਾਨੂੰ ਇੱਥੋਂ ਦਾ ਸਿਲੰਡਰ ਦੀ ਡੇਟ ਸ ਗੈਸ ਸਿਲੰਡਰ ਦੀ ਅਪ ਡ ਅਪਡੇਟ ਹੋ ਜਾਵੇ ਕਿਉਂਕਿ ਇਸ ਦੇ ਬਿਨਾਂ ਤਾਂ ਸਾਡਾ ਗੁਜ਼ਾਰਾ ਵੀ ਨਹੀਂ ਹੋਣਾ ਅਗਰ ਅਸੀਂ ਇਸ ਤਰ੍ਹਾਂ ਨਾ ਕੀਤਾ ਤਾਂ ਸਾਨੂੰ ਤਾਂ ਬਹੁਤ ਮੁਸ਼ਕਿਲ ਹੋ ਜਾਵੇਗੀ ਅਸੀਂ ਇਸ ਪ੍ਰਕਿਰਿਆ ਨੂੰ ਅੱਗੇ ਚਲਾਉਣ ਲਈ ਗੈਸ ਏਜੰਸੀ ਦੇ ਮਾਲਿਕ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਜਲਦੀ ਤੋਂ ਜਲਦੀ ਸਾਡੀ ਗੈਸ ਦੇ ਪਤੇ ਦੀ ਅਪਡੇਟ ਕਰ ਦੇਣ